ਖੇਤੀਬਾੜੀ ਦੀ ਗੱਲ ਕਰੀਏ ਤਾਂ ਅਸੀਂ ਸਰਦੀਆਂ ਵਿੱਚ ਕਣਕ ਲਾਉਂਦੇ ਹਾਂ ਕਣਕ ਦੀ ਖੇਤੀ ਕਰਦੇ ਹਾਂ ਕਣਕਾਂ ਦੀ ਖੇਤੀ ਤੋਂ ਬਾਅਦ ਅਸੀਂ ਮੱਕੀ ਲਾਉਂਦੇ ਹਾਂ ਸਰਦੀਆਂ ਗਰਮੀਆਂ ਵਿੱਚ ਹੁਣ ਅਸੀਂ ਧਾਨ ਦੀ ਬਿਜਾਈ ਕਰਦੇ ਹਾਂ ਧਾਨ ਲਾਉਣ ਨਾਲ ਸਾਨੂੰ ਜ਼ਿਆਦਾ ਪੈਸੇ ਨੂੰ ਕਿ ਕਿਸਾਨਾਂ ਜ਼ਿਆਦਾ ਪੈਸੇ ਮਿਲਦੇ ਆ ਉਸ ਤੋਂ ਬਾਅਦ ਅਸੀਂ ਗੰਨੇ ਦੀ ਬਿਜਾਈ ਕਰਦੇ ਨਾਲ ਦੀ ਨਾਲ ਅਸੀਂ ਗੰਨੇ ਦੀ ਬਿਜਾਈ ਕਰਦੇ ਜਿਸ ਨਾਲ ਕਿ ਸਾਨੂੰ ਖੰਡ ਗੁੜ ਸ਼ੱਕਰ ਬ ਨਾਲ ਮਿਲਦੇ ਖਾਣ ਨੂੰ ਮਿਲਦੇ ਹੈ ਖੇਤੀਬਾੜੀ ਕਰਨ ਨਾਲ ਸਾਨੂੰ ਹਰ ਇੱਕ ਚੀਜ਼ ਖਾਣ ਪੀਣ ਲਈ ਆਪਣੇ ਆਪਣੇ ਖੇਤਾਂ ਵਿੱਚੋਂ ਉਗਾਉਂਦੇ ਅਸੀਂ ਨਾਲ ਦੀ ਨਾਲ ਕਿਸਾਨ ਇਹਨਾਂ ਨੂੰ ਵੇਚ ਕੇ ਵੀ ਪੈਸੇ ਵੀ ਕਮਾ ਸਕਦੇ ਹਨ